ਹਾਂਜੀ ਮੈਨੂੰ ਯੋਗ ਅਭਿਆਸ ਕਰਨ ਤੋਂ ਬਾਅਦ ਬਿਹਤਰ ਮਾਨਸਿਕ ਅਤੇ ਸਰੀਰਕ ਸਿਹਤ ਦਾ ਬਹੁਤ ਵਧੀਆ ਅਨੁਭਵ ਹੋਇਆ ਹੈ ਮੇਰੇ ਰੋਜ਼ਾਨਾ ਜੀਵਨ ਵਿੱਚ ਇਸ ਦੇ ਬਹੁਤ ਚੰਗੇ ਪ੍ਰਭਾਵ ਮੈਨੂੰ ਦੇਖਣ ਨੂੰ ਮਿਲੇ ਮੇਰਾ ਮਨ ਬਹੁਤ ਹੀ ਸ਼ਾਂਤ ਰਹਿੰਦਾ ਹੈ ਹੁਣ ਮੈਂ ਆਪਣੀਆਂ ਭਾਵਨਾਵਾਂ 'ਤੇ ਬਹੁਤ ਚੰਗੀ ਤਰ੍ਹਾਂ ਸੰਤੁਲਨ ਕਰਨਾ ਸਿੱਖ ਲਿਆ ਹੈ ਹੁਣ ਮੇਰੇ ਵਿੱਚ ਬਹੁਤ ਹੀ ਜ਼ਿਆਦਾ ਸਹਿਣ ਸ਼ਕਤੀ ਵੀ ਆਉਣੀ ਸ਼ੁਰੂ ਹੋ ਗਈ ਹੈ ਮੈਨੂੰ ਆਪਣੇ ਸਿਹਤ ਪ੍ਰਤੀ ਬਹੁਤ ਵਧੀਆ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ ਮੇਰੇ ਰੋਜ਼ਾਨਾ ਯੋਗ ਦੇ ਅਭਿਆਸ ਕਰਨ ਤੋਂ ਬਾਅਦ ਮੈਨੂੰ ਆਪਣਾ ਸਰੀਰ ਬਹੁਤ ਹੀ ਹਲਕਾ ਫੁਲਕਾ ਮਹਿਸੂਸ ਹੁੰਦਾ ਹੈ ਜਿਸ ਨਾਲ ਮੇਰੇ ਅੰਦਰ ਇੱਕ ਕੁਦਰਤੀ ਤੌਰ 'ਤੇ ਅੰਦਰੂਨੀ ਸ਼ਕਤੀ ਪੈਦਾ ਹੋ ਗਈ ਹੈ ਜਿਸ ਨਾਲ ਮੈਂ ਆਪਣੇ ਆਪ ਨੂੰ ਖੁਸ਼ੀ ਪ੍ਰਦਾਨ ਕਰ ਸਕਦੀ ਹਾਂ ਇਹ ਯੋਗ ਮੇਰੇ ਰੋਜ਼ਾਨਾ ਜੀਵਨ ਦਾ ਅੰਗ ਬਣ ਗਿਆ ਹੈ ਮੈਂ ਇਸ ਤੋਂ ਬਹੁਤ ਹੀ ਖੁਸ਼ ਹਾਂ ਧੰਨਵਾਦ